ਜੀ ਹਾਂ ਮੈਂ ਫਿਟਨੈਸ ਬੈਂਡ ਦੀ ਵਰਤੋਂ ਕਰਦੀ ਹਾਂ ਫਿਟਨੈਸ ਬੈਂਡ ਅੱਜ ਦੇ ਸਮੇਂ ਦੀ ਬਹੁਤ ਹੀ ਵਧੀਆ ਅਤੇ ਸਹਾਇਕ ਚੀਜ਼ ਹੈ ਫਿਟਨੈਸ ਬੈਂਡ ਇੱਕ ਕਿਸਮ ਦਾ ਡਿਵਾਈਸ ਹੈ ਜੋ ਕਿ ਸਾਡੀ ਸਿਹਤ ਅਤੇ ਤੰਦਰੁਸਤੀ ਦਾ ਖਿਆਲ ਰੱਖਣ ਲਈ ਇਸਤੇਮਾਲ ਹੁੰਦਾ ਹੈ ਫਿਟਨੈਸ ਬੈਂਡ ਵਿੱਚ ਕਈ ਟੀਚਰ ਹੁੰਦੇ ਹਨ ਇਸ ਵਿੱਚ ਅਸੀਂ ਆਪਣੇ ਸਰੀਰ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਰੱਖ ਸਕਦੇ ਹਾਂ ਸਾਨੂੰ ਸਾਡੇ ਸਵਾਸਥ ਦੀ ਨਿਗਰਾਨੀ ਰਹਿੰਦੀ ਹੈ ਅਤੇ ਸਾਨੂੰ ਸਾਡੇ ਫਿਟਨੈਸ ਲੱਛਣਾਂ ਨੂੰ ਸਮਝਣ ਲਈ ਮਦਦ ਕਰਦਾ ਹੈ ਫਿਟਨੈਸ ਬੈਂਡ ਵਿੱਚ ਅਸੀਂ ਆਪਣੇ ਕਦਮਾਂ ਦੀ ਗਿਣਤੀ ਕਲੋਰੀ ਬਰਨ ਹਾਰਟ ਰੇਟ ਨੀਂਦ ਬਾਰੇ ਵੀ ਜਾਣ ਸਕਦੇ ਹਾਂ ਫਿਟਨੈਸ ਬੈਂਡ ਦੇ ਵਿੱਚ ਕਈ ਵਿੱਚ ਇੱਕ ਛੋਟੀ ਸਕਰੀਨ ਵੀ ਹੁੰਦੀ ਹੈ ਅਤੇ ਉਸਦੇ ਪਿੱਛੇ ਇੱਕ ਸੈਂਸਰ ਸੈਂਸਰ ਦੀ ਮਦਦ ਨਾਲ ਵੀ ਅਸੀਂ ਸਾਡੇ ਸਰੀਰ ਦੀ ਸਾਰੀ ਕਿਰਿਆਵਾਂ ਪ੍ਰਾਪਤ ਹੁੰਦੀਆਂ ਹਨ ਅਤੇ ਗਤੀਵਿਧੀ ਹੁੰਦੀ ਹੈ ਫਿਟਨੈਸ ਬੈਂਡ ਨੂੰ ਜਦੋਂ ਗੁਟ 'ਤੇ ਬੰਨਿਆ ਜਾਂਦਾ ਹੈ ਅਤੇ ਉਸ ਦਾ ਸੈਂਸਰ ਐਕਟੀਵੇਟ ਹੋ ਜਾਂਦਾ ਹੈ ਐਕਟੀਵੇਟ ਹੋਣ ਦੇ ਨਾਲ ਸਾਡੇ ਸਰੀਰ ਵਿੱਚ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਬੈਂਡ ਦੀ ਸਕਰੀਨ ਵਿੱਚ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਇਸਦੀ ਮਦਦ ਨਾਲ ਅਸੀਂ ਗੋਲ ਸੈਟ ਕਰਕੇ ਕਸਰਤ ਵੀ ਕਰ ਸਕਦੇ ਹਨ ਇਸ ਦੇ ਬਹੁਤ ਫਾਇਦੇ ਹਨ ਇਹ ਇਹਦੇ ਨਾਲ ਸਾਡੇ ਸਰੀਰ ਠੀਕ ਰਹਿੰਦਾ ਹੈ ਅਤੇ ਸਾਨੂੰ ਆਪਣੇ ਸਰੀਰ ਦੀਆਂ ਸਾਰੀਆਂ ਗਤੀਵਿਧੀਆਂ ਦਾ ਪਤਾ ਚਲਦਾ ਰਹਿੰਦਾ ਹੈ ਧੰਨਵਾਦ